ਸਾਡੇ ਜੀਵਨ ਵਿੱਚ ਚਿੱਤਰਕਾਰੀ ਬਹੁਤ ਹੀ ਵਧੀਆ ਮਤਲਬ ਮਹੱਤਵਪੂਰਨ ਰੋਲ ਅਦਾਨ ਕਰਦੀ ਆ ਸਾਨੂੰ ਚਿੱਤਰਕਾਰੀ ਤੋਂ ਬਹੁਤ ਹੀ ਜ਼ਿਆਦਾ ਮਤਲਬ ਪ੍ਰੇਰਨਾ ਮਿਲਦੀ ਹੈਗੀ ਹੈ ਅਤੇ ਮੈਂ ਖੁਦ ਡਰਾਇੰਗ ਕਰਨਾ ਚਿੱਤਰ ਬਣਾਉਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੀ ਹਾਂ ਮੈਨੂੰ ਕਾਫੀ ਪਸੰਦ ਹੈ ਵੀ ਜਦੋਂ ਵੀ ਆਪਾਂ ਹੈ ਨਾ ਕਿਤੇ ਵੀ ਜਾਂਦੇ ਹਾਂ ਤਾਂ ਉਸ ਚੀਜ਼ ਨੂੰ ਚਿੱਤਰ ਦੇ ਵਿੱਚ ਕੈਦ ਕਰਨਾ ਕਿਉਂਕਿ ਜਦੋਂ ਆਪਾਂ ਚਿੱਤਰ ਬਣਾਉਂਦੇ ਹਾਂ ਉਸ ਨਾਲ ਨਾ ਬੰਦੇ ਦੀ ਮਨ ਦੀ ਭਾਵਨਾ ਵੀ ਜੁੜੀ ਹੁੰਦੀ ਹੈ ਵੀ ਬੜੇ ਬੰਦਾ ਬੜੇ ਪਿਆਰ ਨਾਲ ਬੜਾ ਕੁਛ ਸੋਚ ਕੇ ਉਸ ਚਿੱਤਰ ਨੂੰ ਬਣਾਉਂਦਾ ਹੈ ਬੜੇ ਹੀ ਮਹੱਤਵਪੂਰਨ ਤਰੀਕੇ ਨਾਲ ਸਾਫ ਸੁਥਰੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਉਸ ਚਿੱਤਰ ਨੂੰ ਬਣਾਉਂਦਾ ਹੈ ਆਪਦੇ ਮਨ ਦੇ ਭਾਵ ਉਸ 'ਚ ਪ੍ਰਗਟ ਕਰਦਾ ਹੋਰ ਵੀ ਕਾਫੀ ਚੀਜ਼ਾਂ ਨੇ ਚਿੱਤਰ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਹੈ ਨਾ ਜਿਵੇਂ ਜ਼ਰੂਰੀ ਜ਼ਰੂਰੀ ਹੋਣ ਤੁਹਾਡੇ ਮਤਲਬ ਲਾਈਫ ਦਾ ਜ਼ਰੂਰੀ ਪਾਰਟ ਹੈ ਸਾਰੇ ਲੋਕਾਂ ਦੀ ਆਪਦੀ ਆਪਦੀ ਚੋਇਸਸ ਹੁੰਦੀਆਂ ਪਰ ਜਿਵੇਂ ਕਿ ਹੁਣ ਆਪਾਂ ਦੇਖਦੇ ਹਾਂ ਆਪਣੀ ਅੱਜ ਕੱਲ੍ਹ ਦੀ ਪੜ੍ਹਾਈ ਦੇ ਵਿੱਚ ਸਭ ਤੋਂ ਜ਼ਿਆਦਾ ਡਾਇਗਰਾਮਸ ਇਹੋ ਜਿਹੀਆਂ ਸਾਰੀਆਂ ਡਰਾਇੰਗਸ ਇਹ ਸਾਰਾ ਕੁਛ ਗ੍ਰਾਫਿਕਲ ਇਹ ਸਾਰਾ ਕੁਛ ਦਿੱਤਾ ਗਿਆ ਜਿਹਦੇ ਕਰਕੇ ਇੱਥੇ ਚਿੱਤਰਕਾਰੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਰੱਖਦੀ ਹੈ ਇਸ ਕਰਕੇ ਆਪਾਂ ਬਹੁਤ ਹੀ ਸੋਹਣੀਆਂ ਤਰੀਕੇ ਨਾਲ ਆਪਦਾ ਚਿੱਤਰ ਕਰ ਸਕਦੇ ਹਾਂ ਡਰਾਈਗਰਾਮਸ ਵਗੈਰਾ ਸਾਰਾ ਕੁਛ ਬਣਾ ਸਕਦੇ ਹਾਂ ਆਪਾਂ ਨੂੰ ਹੌਲੀਡੇ ਹੋਮਵਰਕਸ ਮਿਲਦੇ ਹਨ ਗਰਮੀ ਦੀ ਛੁੱਟੀਆਂ ਦੇ ਵਿੱਚ ਅਤੇ ਉਹਦੇ ਕਰਕੇ ਆਪਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਮਹੱਤਵਪੂਰਨ ਤਰੀਕੇ ਨਾਲ ਹੋਰ ਵੀ ਜ਼ਿਆਦਾ ਸਜਾ ਕੇ ਸੁੰਦਰ ਚਿੱਤਰਾਂ ਨਾਲ ਬਣਾ ਕੇ ਉਹਨਾਂ ਨੂੰ ਆਪਾਂ ਬਹੁਤ ਹੀ ਜ਼ਿਆਦਾ ਆਕਰਸ਼ਕ ਦਿਖਾ ਸਕਦੇ ਹਾਂ ਜਿਹਦੇ ਕਰਕੇ ਆਪਣੀ ਟੀਚਰਾਂ ਦਾ ਮਨ ਵੀ ਬਹੁਤ ਜ਼ਿਆਦਾ ਪ੍ਰਸੰਨ ਹੁੰਦਾ ਹੈ ਵੀ ਉਹਨਾਂ ਨੂੰ ਵਧੀਆ ਲੱਗਦਾ ਕਿ ਬੱਚੇ ਨੇ ਚਿੱਤਰ ਬਣਾ ਕੇ ਮਤਲਬ ਆਪਦਾ ਕੀਤਾ ਹੈ ਖਾਸਕਰ ਜਿਹੜੇ ਉਹ ਚਿੱਤਰ ਬਹੁਤ ਹੀ ਮੈਨੂੰ ਸੋਹਣੇ ਲੱਗਦੇ ਹਨ ਜਿਹਨਾਂ ਜਿਹੜੇ ਨਾ ਕਲਪਨਾ ਜਿਹੜੇ ਖੁਦ ਸੋਚ ਕੇ ਮਨ 'ਚ ਰੱਖ ਕੇ ਉਹ ਤਸਵੀਰ ਨਾਲ ਬਣਾਏ ਗਏ ਹਨ ਬਹੁਤ ਹੀ ਜ਼ਿਆਦਾ ਮੈਨੂੰ ਸੋਹਣੇ ਲੱਗਦੇ ਆ ਅਤੇ ਮੈਨੂੰ ਰੰਗ ਬਿਰੰਗੀਆਂ ਫੋਟੋਆਂ ਬਣਾਉਣੀਆਂ ਰੰਗ ਬਿਰੰਗੇ ਚਿੱਤਰ ਬਣਾਉਣੇ ਬਹੁਤ ਜ਼ਿਆਦਾ ਪਸੰਦ ਹਨ ਜਿਵੇਂ ਕਿ ਪੇੜ ਪੌਦੇ ਇਹਨਾਂ ਦੀ ਚਿੱਤਰਕਾਰ ਕਰਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ